ਮੈਂ ਅਜੀਤ ਅਖਬਾਰ ਪੜ੍ਹਦੀ ਹਾਂ ਅਜੀਤ ਅਖਬਾਰ ਦੀਆਂ ਖਬਰਾਂ ਮੈਨੂੰ ਬਹੁਤ ਪਸੰਦ ਹੈ ਠੀਕ ਹੈ ਮੈਂ ਸਵੇਰੇ ਉੱਠ ਕੇ ਚਾਹ ਬਾਅਦ 'ਚ ਪੀਂਦੀ ਹਾਂ ਪਹਿਲਾਂ ਅਖਬਾਰ ਪੜ੍ਹਦੀ ਹਾਂ ਇਸ ਕਰਕੇ ਇਸ ਵਿੱਚ ਰਾਜਨੀਤੀ ਦੀਆਂ ਔਰ ਸਾਡੀ ਖਰੜ ਦੇ ਵਿੱਚ ਆਮ ਆਦਮੀ ਪਾਰਟੀ ਕਰ ਕੀ ਰਹੀ ਹੈ ਅਤੇ ਇਸ ਬਾਰੇ ਜਾਣਨਾ ਚਾਹੁੰਦੀ ਹਾਂ